ਅੱਜ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਰਾਹੀਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਿ ਸਾਡੇ ਸਿੱਖ ਇਤਿਹਾਸ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਏ ਹਨ ਜੋ ਕਿ ਸਿੱਖਾਂ ਦੇ ਨੌਵੇਂ ਗੁਰੂ ਸਨ ਸਾਨੂੰ ਉਹਨਾਂ ਦੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪ੍ਰੇਰਨਾ ਮਿਲਦੀ ਹੈ ਸਿੱਖਿਆ ਸਾਨੂੰ ਮਿਲਦੀ ਹੈ ਕਿ ਉਸ ਟਾਈਮ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਵਿਖੇ ਰਹਿੰਦੇ ਸਨ ਤਾਂ ਉਸ ਟਾਈਮ ਇਹ ਚਾਰੇ ਪਾਸੇ ਮ ਮੁਗਲਾਂ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ ਅਤੇ ਉਸ ਸਮੇਂ ਆਮ ਜਨਤਾ 'ਤੇ ਬਹੁਤ ਸਾਰੇ ਅੱਤਿਆਚਾਰ ਜ਼ੁਲਮ ਹੋ ਰਹੇ ਸਨ ਤਾਂ ਉਸ ਸਮੇਂ ਹਿੰਦੂਆਂ ਨੂੰ ਜਬਰਦਸਤੀ ਇਸਾਈ ਧਰਮ ਵਿੱਚ ਪਰਿਵਰਤਿਤ ਕਰਿਆ ਜਾ ਰਿਹਾ ਸੀ ਇੱਦਾਂ ਨਹੀਂ ਸੀ ਵੀ ਲੋਕ ਆਪਣੀ ਮਰਜ਼ੀ ਦੇ ਅਨੁਸਾਰ ਕਿਸੇ ਧਰਮ ਦੇ ਵਿੱਚ ਜਾ ਰਹੇ ਸੀ ਬਲਕਿ ਉਹਨਾਂ ਨੂੰ ਜ਼ਬਰਦਸਤੀ ਕਿਸੇ ਹੋਰ ਧਰਮ ਦੇ ਵਿੱਚ ਪ੍ਰਵਰਤਿਤ ਕਰਨ ਲਈ ਕਿਹਾ ਜਾ ਰਿਹਾ ਸੀ ਅਗਰ ਉਹ ਕਿਸੇ ਹੋਰ ਧਰਮ ਵਿੱਚ ਪ੍ਰਵਰਤਿਤ ਨਹੀਂ ਹੁੰਦੇ ਸੀ ਆਪ ਹੀ ਆਪਣੇ ਧਰਮ 'ਤੇ ਦ੍ਰਿੜ ਰਹਿੰਦੇ ਤਾਂ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਸੀ ਤਾਂ ਉਸ ਟਾਈਮ ਦੀ ਗੱਲ ਮੈਂ ਆਪ ਜੀ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾਂ ਦੀ ਨੌਵੇਂ ਗੁਰੂ ਹੋਏ ਸਨ ਜਿਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖੀ ਸਰੂਪ ਦੇ ਵਿੱਚ ਸਨ ਉਹਨਾਂ ਨੇ ਹਰ ਧਰਮ ਪ੍ਰਤੀ ਆਪਣਾ ਚੰਗਾ ਵਤੀਰਾ ਰੱਖਿਆ ਅਤੇ ਕਿਸੇ ਧਰਮ ਵੀਰ ਨੂੰ ਪ੍ਰਤੀ ਵੀ ਉਹਨਾਂ ਨੇ ਆਪਣਾ ਮਾੜਾ ਵਤੀਰਾ ਨਹੀਂ ਰੱਖਿਆ ਤਾਂ ਉਸ ਸਮੇਂ ਹਿੰਦੂ ਧਰਮ 'ਤੇ ਬਹੁਤ ਜ਼ਿਆਦਾ ਅੱਤਿਆਚਾਰ ਹੋ ਰਹੇ ਸਨ ਅਤੇ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਧਰਮ ਦੇ ਵਿੱਚ ਪ੍ਰਵਰਤਿਤ ਕਰਿਆ ਜਾ ਰਿਹਾ ਸੀ ਤਾਂ ਉਸ ਟਾਈਮ ਇੱਕ ਹਿੰਦੂਆਂ ਦਾ ਜੱਥਾ ਕਿਰਪਾ ਪੰਡਤ ਸੀਗਾ ਕਿਰਪਾ ਰਾਮ ਉਹਦੀ ਅਗਵਾਈ ਦੇ ਹੇਠ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਉਂਦਾ ਹੈ ਤਾਂ ਉਹ ਜੱਥਾ ਆ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਰਜ ਬੇਨਤੀ ਕਰਦਾ ਕਿ ਗੁਰੂ ਜੀ ਇੱਦਾਂ ਕਰਕੇ ਵੀ ਅਸੀਂ ਤੁਹਾਡੀ ਬਹੁਤ ਮਹਿਮਾ ਸੁਣੀ ਹੈ ਕਿ ਆਪ ਜੀ ਦੇ ਦਰ 'ਤੇ ਜੋ ਕੋਈ ਵੀ ਆਉਂਦਾ ਉਹ ਖਾਲੀ ਨਹੀਂ ਜਾਂਦਾ ਆਪ ਜੀ ਹਰ ਇੱਕ ਦੀ ਜਿਹੜੀ ਗੱਲ ਸੁਣਦੇ ਹੋ ਅਤੇ ਆਪ ਜੀ ਹਰ ਇੱਕ ਦੇ ਨਾਲ ਇਨਸਾਫ ਕਰਦੇ ਹੋ ਤਾਂ ਉਸ ਟਾਈਮ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਕਿ ਇੱਦਾਂ ਅਸੀਂ ਹਿੰਦੂ ਧਰਮ ਨਾਲ ਬਿਲੋਂਗ ਕਰਦੇ ਹਾਂ ਅਤੇ ਸਾਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸਾਨੂੰ ਪਰਿਵਰਤ ਕਰਿਆ ਜਾ ਰਿਹਾ ਜੋ ਅਸੀਂ ਨਹੀਂ ਹੋਣਾ ਚਾਹੁੰਦੇ ਤਾਂ ਗੁਰੂ ਜੀ ਨੇ ਉਸ ਟਾਈਮ ਉਹਨਾਂ ਨੂੰ ਪੁੱਛਿਆ ਵੀ ਹੁਣ ਕੀ ਕੀਤਾ ਜਾਵੇ ਤਾਂ ਉਹਨਾਂ ਨੇ ਕਿਹਾ ਵੀ ਗੁਰੂ ਜੀ ਇਸਲਾਮ ਵਾਲੇ ਇਸਲਾਮ ਧਰਮ ਵਾਲਿਆਂ ਨੇ ਸਾਨੂੰ ਇੱਦਾਂ ਕਿਹਾ ਹੈ ਵੀ ਜਾਂ ਤਾਂ ਇਸਲਾਮ ਵਿੱਚ ਪਰਿਵਰਤਿਤ ਹੋਜੋ ਜਾਂ ਆਪਦੇ ਮੌਤ ਕਬੂਲ ਕਰ ਲਓ ਤਾਂ ਉਸ ਟਾਈਮ ਗੁਰੂ ਜੀ ਨੇ ਬਿਨਾਂ ਕੁਝ ਸੋਚੇ ਸਮਝੇ ਆਪਣੇ ਨੌ ਸਾਲ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਉਸ ਟਾਈਮ ਕਿਹਾ ਵੀ ਗੁਰੂ ਜੀ ਆਪ ਜੀ ਤੋਂ ਵੱਡੀ ਕੋਈ ਸਹੂਲਤ ਨਹੀਂ ਹੋ ਸਕਦੀ ਤਾਂ ਉਸ ਟਾਈਮ ਗੁਰੂ ਤੇਗ ਬਹਾਦਰ ਜੀ ਨੇ ਬਿਨਾਂ ਕੁਝ ਸੋਚੇ ਸਮਝੇ ਹਿੰਦੂਆਂ ਦੀ ਪੱਤ ਰੱਖਣ ਦੇ ਲਈ ਆਪਣੀ ਕੁਰਬਾਨੀ ਦੇਣ ਦੇ ਲਈ ਤਿਆਰ ਹੋ ਗਏ ਤਾਂ ਉਸ ਟਾਈਮ ਸਾਨੂੰ ਬਹੁਤ ਸਾਰੀ ਪ੍ਰੇਰਨਾ ਮਿਲਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਦੀ ਰੱਖਿਆ ਦੇ ਲਈ ਆਪਣੀ ਜਿਹੜੀ ਹੈਗੀ ਆ ਉਹ ਸ਼ਹੀਦੀ ਦੇ ਦਿੱਤੀ ਉਸ ਸਮੇਂ ਦਿੱਲੀ ਚਾਂਦਨੀ ਚੌਂਕ ਵਿਖੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੋ ਇਹ ਇੱਕ ਪ੍ਰੇਰਣਾਦਾਇਕ ਕਹਾਣੀ ਹੈ ਕਿ ਸਾਨੂੰ ਹਮੇਸ਼ਾ ਹੀ ਦੂਸਿਆਂ ਦੀ ਜਿਹੜੀ ਹੈਗੀ ਆ ਮਦਦ ਸਾਨੂੰ ਕਰਨੀ ਚਾਹੀਦੀ ਹੈ ਅਤੇ ਅਸੀਂ ਇਸ ਘਟਨਾ ਦੇ ਇਸ ਜਿਹੜੀ ਹੈਗੀ ਆ ਸਾਡੀ ਇਤਿਹਾਸਕ ਕਹਾਣੀ 'ਤੇ ਅਸੀਂ ਮਾਨ ਮਹਿਸੂਸ ਕਰਦੇ ਹਾਂ ਸਾਡੇ ਗੁਰੂਆਂ 'ਤੇ ਜਿਹਨਾਂ ਨੇ ਆਪਣੇ ਧਰਮ ਹੀ ਨਹੀਂ ਬਲਕਿ ਦੂਸਰੇ ਧਰਮਾਂ ਨੂੰ ਰੱਖਿਆ ਦੇ ਲਈ ਵੀ ਇੱਦਾਂ ਦੇ ਜਿਹੜੇ ਹੈਗੇ ਆ ਕਦਮ ਚੁੱਕੇ